ਮੈਂ ਕੋਈ ਪ੍ਰੋਫੈਸ਼ਨਲ ਸਿੰਗਰ ਨਹੀਂ ਹਾਂ ਜੇਕਰ ਮੈਨੂੰ ਮੌਕਾ ਮਿਲਿਆ ਤਾਂ ਮੈਂ ਹਾਰਮੋਨੀਅਮ ਵਜਾਉਣਾ ਜ਼ਰੂਰ ਚਾਹਾਂਗਾ ਕਿਉਂਕਿ ਮੈਂ ਆਪਣੀਆਂ ਗਜ਼ਲਾਂ ਖੁਦ ਲਿਖਦਾ ਹਾਂ ਅਤੇ ਖੁਦ ਹੀ ਗਾਉਂਦਾ ਹਾਂ ਮੈਂ ਚਾਹੁੰਦਾ ਹਾਂ ਹਾਰਮੋਨੀਅਮ ਦੇ ਮਾਧਿਅਮ ਰਾਹੀਂ ਆਪਣੀ ਗਜ਼ਲਾਂ ਨੂੰ ਗਾ ਕੇ ਮੈਂ ਪੇਸ਼ ਕਰ ਸਕਾਂ